ਹੈਲੋ ਹਾਂਜੀ ਸਾਈਂ ਬੁੱਕ ਸਟੋਰ ਤੋਂ ਗੱਲ ਕਰ ਰਹੇ ਹੋ ਸਟੇਸ਼ਨਰੀ ਦੁਕਾਨ ਤੋਂ ਜੀ ਹਾਂਜੀ ਸਰ ਜੀ ਸਟੇਸ਼ਨਰੀ ਦਾ ਸਮਾਨ ਚਾਹੀਦਾ ਸੀ ਆਪਣੇ ਬੁੱਕਸ ਚਾਹੀਦੀਆਂ ਸੀ ਦੋ ਡੱਬੇ ਪੈਨਸਲਾਂ ਦੇ ਚਾਹੀਦੇ ਸੀ ਏ ਫੋਰ ਦੇ ਰਿਮ ਚਾਹੀਦੇ ਸੀ ਜੀ ਹਾਂਜੀ ਆਪਣੇ ਹਾਂਜੀ ਬੁੱਕਸ ਚਾਹੀਦੀਆਂ ਜੀ ਹਾਂਜੀ ਹਾਂਜੀ ਜੀ ਏ ਫੋਰ ਦੇ ਡੱਬੇ ਆਪਣੇ ਉਹ ਚਾਹੀਦੇ ਸੀ ਅਤੇ ਸਟੇਸ਼ਨਰੀ ਦਾ ਹੋਰ ਵੀ ਜੀ ਸਮਾਨ ਚਾਹੀਦਾ ਜੀ ਮਿਲ ਜਾਵੇਗਾ ਤੁਹਾਡੇ ਕੋਲ ਜੀ ਹਾਂਜੀ ਹਾਂਜੀ ਠੀਕ ਹੈ ਅਤੇ ਭਾਅ ਜੀ ਬੁੱਕਸ ਬੁੱਕਸ ਕਿਹੜੀਆਂ ਕਿਹੜੀਆਂ ਮਿਲ ਜਾਣਗੀਆਂ ਜੀ ਆਪਣੇ ਕੋਲੋਂ ਹਾਂਜੀ ਕਲਾਸ ਕਲਾਸ ਕਲਾਸ ਵਾਲੀਆਂ ਚਾਹੀਦੀਆਂ ਸੀ ਜੀ ਆਪਣੇ ਛੇਵੀਂ ਕਲਾਸ ਦੀ ਵੀ ਮੈਨੂੰ ਚਾਹੀਦੀਆਂ ਸੀ ਸੱਤਵੀਂ ਦੀਆਂ ਵੀ ਅੱਠਵੀਂ ਦੀਆਂ ਵੀ ਨੌਂਵੀਂ ਦੀਆਂ ਵੀ ਅਤੇ ਅਤੇ ਆਪਣੇ ਵੀ ਕੁਛ ਨੋਵਲਸ ਵਗੈਰਾ ਵੀ ਚਾਹੀਦੀਆਂ ਨੇ ਜਿਵੇਂ ਕਹਾਣੀਆਂ ਕਹੂਣੀਆਂ ਬੱਚਿਆਂ ਨੂੰ ਪੜ੍ਹਨ ਵਾਸਤੇ ਹਾਂਜੀ ਪੰਜਾਬ ਬੋਰਡ ਦੀਆਂ ਜੀ ਚਾਹੀਦੀਆਂ ਜੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਪੰਜਾਬੀ ਮੀਡੀਅਮ ਹੈ ਕੁਝ ਬੱਚੇ ਹੈ ਜੀ ਜਿਨ੍ਹਾਂ ਨੂੰ ਇੰਗਲਿਸ਼ ਮੀਡੀਅਮ ਹੈ ਜੀ ਉਹ ਤੁਹਾਨੂੰ ਦੇਖ ਕੇ ਆਡਰ ਦੇ ਦੇਵਾਂਗੇ ਜੀ ਅਤੇ ਬਾਕੀ ਤੁਹਾਡੀ ਭਾਅ ਜੀ ਡਿਲਵਰੀ ਦਾ ਵੀ ਆਪਣਾ ਹੈਗਾ ਜੀ ਸ਼ਡਿਊਲ

ਹਾਂਜੀ ਭਾਅ ਜੀ ਕਿੰਨੇ ਠੀਕ ਹੈ ਭਾਅ ਜੀ ਕਿੰਨੇ ਦਿਨਾਂ 'ਚ ਆਪਣੇ ਹੋਜੂਗੀ ਜੀ ਡਿਲਵਰੀ ਹਾਂਜੀ ਭਾਅ ਜੀ ਫਾਜ਼ਿਲਕਾ ਆਪਾਂ ਨੂੰ ਚਾਹੀਦੀਆਂ ਜੀ ਫਾਜ਼ਿਲਕਾ ਸਕੂਲ ਹੈਗਾ ਜੀ ਆਪਣੇ ਉੱਥੇ ਸਕੂਲ 'ਚ ਪ੍ਰੋਵਾਈਡ ਚਾਹੀਦੀਆਂ ਸਾਰਾ ਸਟੇਸ਼ਨਰੀ ਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਸਰਕਾਰੀ ਬੋਆਏ ਸਕੂਲ ਚਾਹੀਦੀਆਂ ਜੀ ਠੀਕ ਹੈ ਭਾਅ ਜੀ ਅਤੇ ਅਤੇ ਆਪਣੇ ਭਾਅ ਜੀ ਇਨ੍ਹਾਂ ਦੇ ਰੇਟ ਵਗੈਰਾ ਤੁਸੀਂ ਕਿਨ ਕੀ ਹਿਸਾਬ ਨਾਲ ਲਾਓਗੇ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਇਨ੍ਹਾਂ ਦੀ ਜਿਹੜੀ ਬਿਲਿੰਗ ਵਗੈਰਾ ਆਪਣੀ ਜੀ ਐੱਸ ਟੀ ਅਕੋਡਿੰਗ ਹੋਊਗੀ ਸਾਰੀ ਜੀ ਜੀ ਐੱਸ ਟੀ ਦਾ ਬਿੱਲ ਪੱਕਾ ਬਣਾ ਕੇ ਦਿਓਗੇ ਜੀ ਹਾਂਜੀ ਹਾਂਜੀ ਹਾਂਜੀ ਬਿਲਿੰਗ ਭਾਅ ਜੀ ਨਾ ਅਸੀਂ ਪ੍ਰੋਪਰ ਲਵਾਂਗੇ ਜੀ ਬਿਲਿੰਗ ਦੇ ਰਿਕੋਡ ਹਾਂਜੀ ਠੀਕ ਹੈ ਭਾਅ ਜੀ ਅਸੀਂ ਨਾ ਤੁਹਾਨੂੰ ਠੀਕ ਹੈ ਠੀਕ ਹੈ ਤੁਹਾਡੀ ਗੱਲ ਸਹੀ ਹੈ ਜੀ ਅਤੇ ਆਪਣੇ ਤੁਸੀਂ ਆਲ ਓਵਰ ਕਰ ਦਿਓ ਅਤੇ ਦੋ ਤਿੰਨ ਦਿਨਾਂ ਵਿੱਚ ਸਾਡਾ ਪਾਰਸਲ ਪਹੁੰਚ ਜਾਵੇਗਾ ਜੀ ਤੁਹਾਡੀ ਗੱਲ ਸਹੀ ਹੈ ਜੀ ਠੀਕ ਹੈ ਜੀ